ਮੈਨੂੰ ਸ਼ੁਰੂ ਤੋਂ ਹੀ ਜਿਵੇਂ ਕਿ ਸਬਜ਼ੀਆਂ ਲਗਾਉਣਾ ਜਾਂ ਫੁੱਲ ਵਗੈਰਾ ਲਗਾਉਣਾ ਬਹੁਤ ਸ਼ੌਕ ਹੈ ਇਹਨਾਂ ਦਾ ਹੈ ਨਾ ਸ਼ੁਰੂ ਤੋਂ ਮੈਂ ਛੋਟੀ ਹੁੰਦੀ ਤੋਂ ਹੀ ਬਹੁਤ ਗ ਫੁੱਲ ਵਗੈਰਾ ਦੇ ਬੂਟੇ ਲਗਾਉਂਦੀ ਹੁੰਦੀ ਸੀ ਸਬਜ਼ੀਆਂ ਵਗੈਰਾ ਲਗਾਉਂਦੀ ਹੁੰਦੀ ਸੀ ਮੰਮਾ ਦੀ ਹੈਲਪ ਕਰਵਾਉਂਦੀ ਹੁੰਦੀ ਸੀ ਅਤੇ ਜਿਵੇਂ ਹੁਣ ਇਹਨੂੰ ਸਾਂਭ ਸੰਭਾਲ ਨੂੰ ਆਪਾਂ ਦੇਖ ਲੈਂਦੇ ਹਾਂ ਹੈ ਨਾ ਸਬਜ਼ੀਆਂ ਲਾਈਆਂ ਉਹਨਾਂ ਵਿੱਚ ਘਾਹ ਘੂਹ ਉੱਗ ਜਾਂਦਾ ਉਹਨੂੰ ਪੁੱਟਣਾ ਹੈ ਨਾ ਵੀ ਗੋਡੀ ਕਰਨੀ ਆ ਟਾਈਮ 'ਤੇ ਟਾਈਮ ਉਹਨੂੰ ਪਾਣੀ ਦੇਣਾ ਸਬਜ਼ੀਆਂ ਨੂੰ ਹੈ ਨਾ ਅਤੇ ਜੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਜਿਵੇਂ ਵੀ ਬਿਮਾਰੀ ਕੋਈ ਕੀੜਾ ਲੱਗ ਜਾਂਦਾ ਹੈ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਉਹਦੀ ਦਵਾਈ ਦੀ ਸਪਰੇ ਕਰਨੀ ਹੈ ਤਾਂ ਘਰੇਲੂ ਨੁਕਸੇ ਨੁਕਸੇ ਵਰਤ ਲੈਣੇ ਹੈ ਜਿਵੇਂ ਕਿ ਨਿੰਮ ਹੋ ਗਈ ਹੈ ਨਾ ਨਿੰਮ ਨੂੰ ਉਬਾਲ ਕੇ ਉਹਦੇ ਪਾਣੀ ਦੀ ਸਪਰੇ ਕਰਨੀ ਲੂਣ ਨੂੰ ਪਾਣੀ 'ਚ ਘੋਲ ਕੇ ਉਹਦੀ ਸਪਰੇ ਕਰਨੀ ਨਾ ਇੱਦਾਂ ਦੀਆਂ ਚੀਜ਼ਾਂ ਸਪਰੇ ਕਰਨ ਨਾਲੋਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਸਬਜ਼ੀਆਂ ਨੂੰ ਸੁੰਡੀ ਵਗੈਰਾ ਜੇ ਲੱਗਦੀ ਸੀ ਤਾਂ ਉਹ ਮਰ ਜਾਂਦੀ ਸੀਗੀ ਇੱਦਾਂ ਬਹੁਤ ਨੁਕਸ ਘਰੇਲੂ ਜਿਹੜੇ ਸੀ ਆਪਾਂ ਵਰਤਦੇ ਹੁਦੇ ਸੀ ਜਿਹੜੇ ਸਾਡੇ ਵੀ ਸਿਹਤ ਲਈ ਵਧੀਆ ਹੁੰਦੇ ਸੀਗੇ ਕਿਉਂਕਿ ਜੇ ਬਜ਼ਾਰੀ ਦਵਾਈਆਂ ਜ਼ਿਆਦਾ ਸਪਰੇਆਂ ਕਰਦੇ ਬਜ਼ਾਰੀ ਤਾਂ ਫਿਰ ਸਾਨੂੰ ਸਾਨੂੰ ਵੀ ਉਹਦੇ ਵਿੱਚ ਸਾਡੀ ਵੀ ਹਾਨੀ ਸੀਗੀ ਸਾਡੀ ਵੀ ਸਿਹਤ ਖਰਾਬ ਹੋਣੀ ਸੀ ਕਿਉਂਕਿ ਦਵਾਈਆਂ ਦੀ ਐਨੀ ਛਿੜਕਾਅ ਹੋਣੀ ਹੈ ਨਾ ਅਤੇ ਹੌਲੀ ਹੌਲੀ ਮਤਲਬ ਬਗੀਚੇ ਨੂੰ ਸਾਫ ਸੁਥਰਾ ਰੱਖਣਾ ਉਹਦੇ 'ਚੋਂ ਘਾਹ ਘੂਹ ਕੱਢੀ ਜਾਣਾ ਹੈ ਨਾ ਟਾਈਮ ਟੂ ਟਾਈਮ ਸਭ ਕੁਝ ਸਬਜ਼ੀਆਂ ਨੂੰ ਪਾਣੀ ਪੂਣੀ ਦੇਣਾ ਇਹ ਸਾਰੀ ਸਾਂਭ ਸੰਭਾਲ ਨਾ ਬੂਟਿਆਂ ਦੀ ਕਰਨੀ ਜਦੋਂ ਤੱਕ ਵੱਡੇ ਨਹੀਂ ਹੋ ਜਾਂਦੇ ਫਿਰ ਜਿਹੜੀਆਂ ਸਬਜ਼ੀਆਂ ਆਪਾਂ ਲਾਉਂਦੇ ਹੁੰਦੇ ਸੀ ਜਾਂ ਫੁੱਲ ਲਗਾਉਂਦੇ ਹੁੰਦੇ ਸੀ ਫੁੱਲਾਂ ਦਾ ਤਾਂ ਚਲੋ ਜੇ ਜ਼ਿਆਦਾ ਗਾਡ ਗਾਡ ਹੋਵੇ ਆਪਣਾ ਜ਼ਿਆਦਾ ਬਗੀਚਾ ਹੋਵੇ ਤਾਂ ਫਿਰ ਅਸੀਂ ਜਿਹੜੇ ਫੁੱਲ ਜ਼ਿਆਦਾ ਹੁੰਦੇ ਸੀ ਤਾਂ ਆਪਾਂ ਅੱਧੇ ਕੁ ਵੇਚ ਵੀ ਆਉਂਦੇ ਹੁੰਦੇ ਸੀ ਹੈ ਨਾ ਅਤੇ ਜਿਹੜੀਆਂ ਸਬਜ਼ੀਆਂ ਸੀ ਉਹ ਤਾਂ ਜ਼ਿਆਦਾਤਰ ਅਸੀਂ ਘਰ ਵੀ ਵਰਤੋਂ ਵਿੱਚ ਲਿਆਉਂਦੇ ਸੀ ਆਂਢ ਗੁਆਂਢ 'ਚ ਦੇ ਦਿੰਦੇ ਹੁੰਦੇ ਸੀ ਹੈ ਨਾ ਅਤੇ ਇਹਨਾਂ ਨੂੰ ਸਾਂਭ ਸੰਭਾਲ ਲਈ ਅਤੇ ਇਹੀ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ ਕਿ ਇਹਨਾਂ 'ਚੋਂ ਸਫਾਈ ਕਰ ਲਉ ਅਤੇ ਇਹਨਾਂ ਦਾ ਜੇ ਕੋਈ ਸੁੰਡੀ ਸਾਂਡੀ ਲੱਗ ਜਾਂਦੀ ਸੀ ਸਪਰੇ ਵਗੈਰਾ ਕਰ ਲਈ ਦੀ ਸੀ ਇੱਦਾਂ ਹੀ ਬਸ ਸਾਰੀ ਇਹਨਾਂ ਦੀ ਸਾਂਭ ਸੰਭਾਲ ਹੁੰਦੀ ਰਹਿੰਦੀ ਸੀ